ਅੱਜ ਕੱਲ੍ਹ ਜਿਹੜੀ ਟਰਾਂਸਫੋਰ ਟਰਾਂਸਪੋਰਟ ਦੀ ਸਰਵਿਸਿਜ਼ ਹੈ ਬਹੁਤ ਵਧੀਆ ਨੇ ਜਿਵੇਂ ਆਹ ਬੱਸਾਂ ਨੇ ਰੇਲਵੇ ਹੈ ਬਹੁਤ ਸਹੀ ਢੰਗ ਨਾਲ਼ ਜਿਹੜੇ ਹੈਗਾ ਆਪਾਂ ਇੱਕ ਤੋਂ ਦੂਜੀ ਜਗ੍ਹਾ ਸਫ਼ਰ ਬੜੀ ਆਸਾਨੀ ਨਾਲ ਘੱਟ ਟਾਈਮ ਵਿੱਚ ਕਰ ਸਕਦੇ ਹਾਂ ਜਿਹੜੀਆਂ ਬੱਸਾਂ ਨੇ ਹੁਣ ਇੰਨੀਆਂ ਬੱਸਾਂ ਹੋਣ ਦੇ ਨਾਲ ਕੀ ਫਟਾਫਟ ਆਪਣੇ ਟਾਈਮ ਦੀ ਜਿਹੜੀ ਹੈ ਬੱਚਤ ਹੋ ਗਈ ਹੈ ਜਿਸ ਤਰ੍ਹਾਂ ਬਹੁਤ ਸਾਰੇ ਕਾਰੋਬਾਰੀ ਹੈ ਆਪਣੀ ਵਹੀਕਲ 'ਤੇ ਵੀ ਵਰਤੋਂ ਕਰਦੇ ਨੇ ਕਾਰ ਨਾਲ ਵੀ ਸਕੂਟਰ ਵਹੀਕਲ ਆਪਣਾ ਜੋ ਜੋ ਉਹਨਾਂ ਨੂੰ ਮਤਲਬ ਚੰਗੀਆਂ ਸਹੂਲਤਾਂ ਦੇ ਦੇਣ ਉਹਦੇ ਨਾਲ਼ ਉਹ ਆਪਣੇ ਸਮੇਂ 'ਤੇ ਜਿਹੜਾ ਹੈਗੇ ਆ ਆਪਣੇ ਰੁਜ਼ਗਾਰ 'ਤੇ ਆਪਣੇ ਆਪਣੇ ਕੰਮਾਂ 'ਤੇ ਪਹੁੰਚ ਸਕਦੇ ਨੇ ਰੇਲਵੇ ਲਾਈਨਾਂ ਦੇ ਨਾਲ ਰੇਲਵੇ ਜਿਹੜੀ ਹੈਗੀ ਹੈ ਇਹਦੇ ਨਾਲ ਜਿਹੜਾ ਹੈਗਾ ਹੋਰ ਜਿਹੜਾ ਸੌਖਾ ਹੋ ਗਿਆ ਹੁਣ ਅੱਜ ਕੱਲ੍ਹ ਦੇ ਜਿਹੜੇ ਟਾਈਮ ਦੀ ਜੇ ਮੈਟਰੋ ਬੜੀਆਂ ਚੱਲ ਗਈਆਂ ਨੇ ਮੈਟਰੋ ਦੇ ਨਾਲ ਕੀ ਹੈ ਕਿ ਲੋਕਲ ਮੈਟਰੋ ਚੱਲਣ ਨਾਲ਼ ਕੀ ਹੈ ਕਿ ਉਹ ਜਿਹੜੇ ਛੋਟੇ ਛੋਟੇ ਰੁਜ਼ਗਾਰ ਸੀਗੇ ਰੁਜ਼ਗਾਰ ਜਿਹੜੇ ਕਰਨ ਜਾਂਦੇ ਸੀਗੇ ਵ ਵਿਆਪਾਰੀ ਸੀਗੇ ਉਹਨਾਂ ਨੂੰ ਬਹੁਤ ਆਸਾਨੀ ਹੋਈ ਹੈ ਆਪਣਾ ਸਮਾਨ ਇੱਧਰ ਤੋਂ ਉੱਧਰ ਲੈ ਕੇ ਜਾਣਾ ਰੁਜ਼ਗਾਰ ਦਾ ਸਮਾਨ ਲੈ ਕੇ ਜਾਣਾ ਉਹਦੇ ਨਾਲ਼ ਬਹੁਤ ਸਹੂਲਤਾਂ ਹੋਈਆਂ ਨੇ ਬੜਾ ਚੰਗਾ ਉਹਨਾਂ ਦਾ ਸਫ਼ਰ ਨਿਕਲਦਾ ਹੈ ਅਤੇ ਬੜੇ ਆਸਾਨੀ ਨਾਲ਼ ਸਮਾਂ ਘੱਟ ਲੱਗਣ ਨਾਲ ਰੁਜ਼ਗਾਰ ਦਾ ਉੱਨਤੀ ਵੀ ਹੋ ਰਹੀ ਹੈ